ਹਾਂ ਅੱਜ ਕੱਲ ਦੀ ਤਕਨੀਕਾਂ 'ਚ ਸਿਲਾਈ 'ਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ ਤੇ ਬਹੁਤ ਸਾਰੀਆਂ ਨਵੀਆਂ ਨਵੀਆਂ ਤਬਦੀਲੀਆਂ ਆ ਚੁੱਕੀਆਂ ਹਨ ਕੜਾਈ ਵਾਲੀ ਅਲੱਗ ਮਸ਼ੀਨ ਆ ਗਈ ਆ ਬੁਣਾਈ ਵਾਲੀ ਅਲੱਗ ਮਸ਼ੀਨ ਆ ਗਈ ਹੈ ਤੇ ਜਿਹਦੇ 'ਚ ਡਿਜ਼ਾਇਨ ਪੇਂਟ ਵਾਲੀ ਅਲੱਗ ਮਸ਼ੀਨ ਆ ਗਈ ਜਿਹੜਾ ਪੇਂਟ ਕਰਕੇ ਅਸੀਂ ਫੈਬਰਿਕ ਦੇ ਉੱਤੇ ਸਿੱਧਾ ਹੀ ਕੜਾਈ ਕਰ ਸਕਦੇ ਆਂ ਪਰ ਮੈਨੂੰ ਜਿਹੜੀ ਹ ਪੁਰਾਣੀ ਤਕਨੀਕ ਈ ਪਸੰਦ ਸੀ ਜਿਹੜੀ ਹੱਥ ਦੀ ਸਫਾਈ ਹੁੰਦੀ ਹ ਜਿਹੜੇ ਹੱਥ ਨਾਲ ਸੂਈ ਨਾਲ ਪਰੋਇਆ ਜਾਂਦਾ ਐ ਸਮਾਨ ਉਹਦਾ ਚਾਅ ਵੀ ਬੜਾ ਹੁੰਦਾ ਤੇ ਉਹ ਮਜ਼ਾ ਵੀ ਬੜਾ ਆਉਂਦਾ ਉਹ ਚੀਜ਼ ਦਾ ਕੰਮ ਕਰਕੇ ਇਸ ਕਰਕੇ ਮੈਨੂੰ ਪੁਰਾਣੀਆਂ ਤਕਨੀਕਾਂ ਜਿਆਦਾ ਪਸੰਦ ਸੀ ਤੇ ਮੈਨੂੰ ਹੁਣ ਦੀਆਂ ਤਕਨੀਕਾਂ ਤੇ ਨੋ ਡਾਊਟ ਬਹੁਤ ਜਿਆਦਾ ਈਜ਼ੀ ਹੋ ਚੁੱਕੀਆਂ ਨੇ ਪਰ ਮੈਨੂੰ ਪੁਰਾਣੀਆਂ 'ਚ ਈ ਮਜ਼ਾ ਆਉਂਦਾ ਸੀ ਕਿਉਂਕਿ ਉਹ ਮੈਨੂੰ ਖੁਸ਼ੀ ਮਿਲਦੀ ਸੀ ਪਹਿਲਾਂ ਤਾਂ ਮੈਨੂੰ ਸਿੱਖਣ ਚ ਬਹੁਤ ਟਾਈਮ ਲੱਗ ਗਿਆ ਜਦੋਂ ਜਦੋਂ ਇਹ ਕੰਮ ਮੈਨੂੰ ਆ ਗਿਆ ਉਸ ਤੋਂ ਬਾਅਦ ਮੈਨੂੰ ਇਸ ਚੀਜ਼ ਦਾ ਮਜ਼ਾ ਆਉਣਾ ਸ਼ੁਰੂ ਹੋ ਗਿਆ ਇਸ ਕਰਕੇ ਮੈਨੂੰ ਹੁਣ ਜਿਹੜੀਆਂ ਪੁਰਾਣੀਆਂ ਜਿਹੜੀਆਂ ਤਕਨੀਕਾਂ ਸੀ ਆਪਣੇ ਹੱਥ ਨਾਲ ਕਟਾਈ ਕਰਨੀ ਛਾਂਟਿੰਗ ਕਰਨੀ ਇੱਕ ਇੱਕ ਜਿਹੜੀ ਮੋਤੀ ਜਿਹੜੇ ਲਗਾਣੇ ਸੂਈ ਨਾਲ ਬਟਨ ਲਗਾਣੇ ਤਰਪਾਈ ਕਰਨੀ ਉਹ ਚੀਜ਼ ਅੱਜ ਆਪਣਾ ਹੀ ਮਜਾ ਤੇ ਉਹ ਮੈਨੂੰ ਬਹੁਤ ਪਸੰਦ ਹ ਤੇ ਇਸ ਕਰਕੇ ਮੈਨੂੰ ਪੁਰਾਣੀਆਂ ਚੀਜ਼ਾਂ ਹੀ ਜਿਆਦਾ ਪਸੰਦ ਸਭ ਤੋਂ ਔਖਾ ਪਹਿਰਾਵਾ ਤੇ ਮੈਨੂੰ ਇਦਾਂ ਦਾ ਕੋਈ ਨਹੀਂ ਲੱਗਾ ਹਾਂ ਪਰ ਮੈਨੂੰ ਮੇਰੇ ਵਾਸਤੇ ਹੁਣ ਜਦੋਂ ਸਾਰਾ ਕੁਝ ਆ ਗਿਆ ਇਸ ਕਰਕੇ ਹੁਣ ਕੋਈ ਵੀ ਚੀਜ਼ ਔਖੀ ਨੀ ਲੱਗਦੀ ਪਹਿਰਾਵਾ ਸਾਰੀਆਂ ਚੀਜ਼ਾਂ ਮੈਂ ਬਣਾ ਹੀ ਲੈਦੀ ਆ ਤਕਰੀਬਨ ਤੇ ਇਸ ਕਰਕੇ ਮੈਨੂੰ ਪਹਿਲਾਂ ਨਾਲ ਹੁਣ ਦੀ ਤਕਨੀਕ ਨਾਲੋ ਪਹਿਲਾਂ ਦੀ ਤਕਨੀਕ ਜ਼ਿਆਦਾ ਵਧੀਆ ਲੱਗਦੀ ਸੀ